ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਪਿੰਡਾਂ ਦੇ ਵਿੱਚੋਂ ਬਾਹਰ ਯਾਤਰਾ ਕਰਨ ਦੇ ਟਾਈਮ ਬਹੁਤ ਤਰ੍ਹਾਂ ਦੀ ਪ੍ਰੋਬਲਮਾਂ ਪੈਂਦੀਆਂ ਹਨ ਜਿਵੇਂ ਕਿ ਟਰਾਂਸਪੋਰਟ ਦੀ ਗੱਲ ਕਰਦੇ ਜਾਵੇ ਬੱਸਾਂ ਉਰੋ ਪਹਿਲੀ ਗੱਲ ਤਾਂ ਟਰਾਂਸਪੋਰਟ ਸਾਡੇ ਪਿੰਡਾਂ ਤੋਂ ਬਹੁਤ ਹੀ ਦੂਰ ਹੈ ਜਦੋਂ ਉੱਥੇ ਦੀਆਂ ਟਰਾਂਸਪੋਰਟ ਦੀਆਂ ਜਿਹੜੀਆਂ ਬੱਸਾਂ ਏ ਆ ਬੱਸਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਯਾਤਰੀ ਭਰੇ ਹੁੰਦੇ ਹਨ ਜਿਹਦੇ ਕਰਕੇ ਸਾਨੂੰ ਸਫਰ ਕਰਨ ਦੇ ਵਿੱਚ ਵੀ ਪ੍ਰੋਬਲਮ ਪੈਂਦੀ ਹੈ ਅਤੇ ਅਗਰ ਆਪਾਂ ਦੂਜੀ ਕ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੀ ਜਿਹੜੀ ਸੜਕਾਂ ਦੀ ਹਾਲਤ ਬਹੁਤ ਹੀ ਮਾੜੀ ਹੈ